ਸਾਡੀ ਜਿਹੜੀ ਮਾਤਰ ਭਾਸ਼ਾ ਉਹ ਪੰਜਾਬੀ ਹੈ ਸਾਡੇ ਪਿਛਲੇ ਸਮਿਆਂ ਤੋਂ ਜਿਹੜੇ ਪੰਜਾਬੀ ਹੈ ਉਹ ਬਹੁਤ ਬੋਲੀ ਜਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਵੀ ਬੱਚੇ ਪੰਜਾਬੀ ਬੋਲੀ ਜਾਵੇ ਤਾਂ ਜੋ ਕਿ ਸਾਡੇ ਬੱਚਿਆਂ ਨੂੰ ਵੀ ਪੰਜਾਬੀ ਵਿੱਚ ਗੱਲ ਕਰਨ ਦੀ ਆਦਤ ਪੈ ਜੇ ਕਈ ਬੱਚੇ ਤਾਂ ਇਸ ਤਰ੍ਹਾਂ ਦੇ ਨੇ ਜਿਹਨਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਇਸ ਕਰਕੇ ਬੱਚਿਆਂ ਨੂੰ ਬੜੀ ਤੰਗੀ ਆ ਰਹੀ ਹੈ ਪਰ ਅੱਜ ਕ ਅੱਜ ਅਸੀਂ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਸਾਰਿਆਂ ਨੂੰ ਪੰਜਾਬੀ ਬੋਲਣੀ ਆਏ ਅਸੀਂ ਘਰਾਂ ਵਿੱਚ ਵੀ ਬੱਚਿਆਂ ਨਾਲ ਥੋੜ੍ਹਾ ਜਿਹਾ ਅਗਰ ਪੰਜਾਬੀ ਵਿੱਚ ਬੋਲੀਏ ਤਾਂ ਸਾਡੇ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਵਿੱਚ ਥੋੜ੍ਹੀ ਜਿਹੀ ਆਸਾਨੀ ਹੋਏਗੀ ਜਿਹਨਾਂ ਬੱਚਿਆਂ ਨੂੰ ਤਾਂ ਪੰਜਾਬੀ ਬੋਲਣੀ ਨਹੀਂ ਆਉਂਦੀ ਉਹਨਾਂ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਪੰਜਾਬੀ ਯੂਸ ਕਰਨ ਵਰਤਦੇ ਹਨ ਕਿਉਂਕਿ ਪੰਜਾਬੀ ਬੋਲੀ ਜਿਹਨਾਂ ਨੂੰ ਤਾਂ ਆਉਂਦੀ ਹੈ ਉਹਨਾਂ ਲਈ ਬੜੀ ਇੱਕ ਵਧੀਆ ਭਾਸ਼ਾ ਹੈ ਪਰ ਜਿਹਨਾਂ ਨੂੰ ਨਹੀਂ ਆਉਂਦੀ ਉਹਨਾਂ ਲਈ ਥੋੜ੍ਹੀ ਜਿਹੀ ਸਮੱਸਿਆ ਪੈਦਾ ਕਰਦੀ ਹੈ ਅੱਜ ਕੱਲ ਤਾਂ ਸਭ ਕਿਸੇ ਨੂੰ ਪੰਜਾਬੀ ਵਿੱਚ ਬੋਲਣਾ ਆਉਣਾ ਚਾਹੀਦਾ ਹੈ ਅਸੀਂ ਤਾਂ ਬੱਚਿਆਂ ਨੂੰ ਵੀ ਥੋੜ੍ਹਾ ਬਹੁਤ ਪੰਜਾਬੀ 'ਚ ਬੋਲਾਂਗੇ ਤਾਂ ਉਹਨਾਂ ਨੂੰ ਵੀ ਪੰਜਾਬੀ ਬੋਲਣੀ ਆਏਗੀ ਪੰਜਾਬੀ ਬੋਲਾਂਗੇ ਤਾਂ ਇਸ ਨਾਲ ਸਾਨੂੰ ਪੰਜਾਬੀ ਲਿਖਣ 'ਚ ਵੀ ਆਸਾਨੀ ਹੋਏਗੀ ਕਈ ਬੱਚਿਆਂ ਨੂੰ ਤਾਂ ਪੰਜਾਬੀ ਬੋਲਣੀ ਤਾਂ ਜੋ ਕਿ ਲਿਖਣੀ ਵੀ ਨਹੀਂ ਆਉਂਦੀ ਇਸ ਕਰਕੇ ਅੱਜ ਕੱਲ ਦਸਵੀਂ ਤੱਕ ਤਾਂ ਵੈਸੇ ਹੀ ਆਮ ਪੰਜਾਬੀ ਬੋਲੀ ਜਾ ਰਹੀ ਹੈ ਅੱਜ ਕੱਲ ਤਾਂ ਦਸਵੀਂ ਤੋਂ ਬਾਅਦ ਵੀ ਪਲਸ ਵਨ ਪਲਸ ਟੂ ਵਿੱਚ ਵੀ ਪੰਜਾਬੀ ਸਬਜੈਕਟ ਸਲੈਕਟ ਰੱਖਿਆ ਗਿਆ ਹੈ ਜਿਸ ਕਰਕੇ ਕਿ ਬੱਚੇ ਪੰਜਾਬੀ ਵੀ ਰੱਖਣ ਪੰਜਾਬੀ ਨੂੰ ਬੋਲਣ ਉਹਨੂੰ ਸਿੱਖਣ ਉਹਦੀ ਭਾਸ਼ਾ ਨੂੰ ਸਮਝਣ ਤਾਂ ਜੋ ਕਿ ਅੱਗੇ ਜਾ ਕੇ ਵੀ ਉਹ ਕਿਸੇ ਨੂੰ ਪੰਜਾਬੀ 'ਚ ਕਿਸੇ ਨਾਲ ਗੱਲ ਕਰ ਸਕਣ ਉਹਨਾਂ ਨੂੰ ਮੁਸ਼ਕਲ ਨਾ ਹੋਏ ਪੰਜਾਬੀ ਜਿਹੜੀ ਕਿ ਸਾਡੀ ਬਹੁਤ ਵਧੀਆ ਭਾਸ਼ਾ ਹੈ